ਹਾਂਜੀ ਮੈਨੂੰ ਉੱਚਾਈਆਂ ਤੋਂ ਬਹੁਤ ਡਰ ਲੱਗਦਾ ਸੀ ਬਚਪਨ ਵਿੱਚ ਮੈਂ ਛੱਤ 'ਤੇ ਜਦੋਂ ਵੀ ਜਾਂਦਾ ਸੀ ਪਤੰਗਬਾਜ਼ੀ ਕਰਨ ਅਤੇ ਮੈਨੂੰ ਛੱਤ 'ਤੇ ਖੜ੍ਹੇ ਹੋ ਕੇ ਗਲੀ ਵਿੱਚ ਵੇਖਣ 'ਚ ਬਹੁਤ ਡਰ ਲੱਗਦਾ ਸੀ ਮੈਨੂੰ ਇੰਝ ਫੀਲ ਹੁੰਦਾ ਸੀ ਜਿਵੇਂ ਕਿ ਮੈਂ ਡਿੱਗ ਜਾਣਾ ਫਿਰ ਇਸ ਤੋਂ ਬਚਣ ਲਈ ਮੈਂ ਡਾਕਟਰਾਂ ਦੀ ਮਦਦ ਲਈ ਜਿਹਨਾਂ ਨੇ ਕਿ ਮੈਨੂੰ ਦਵਾਈਆਂ ਦੇ ਕੇ ਸਟਰੈਸ ਦੂਰ ਕਰਕੇ ਮੈਨੂੰ ਸਮਝਾਇਆ ਥੈਰਿਪਿਸਟ ਦੀ ਸਹਾਇਤਾ ਲਈ ਕਿ ਡਰਨ ਨਾਲ ਕੁਛ ਨਹੀਂ ਹੁੰਦਾ ਉਚਾਈਆਂ ਉਹ ਅੱਪ ਡਾਊਨਜ ਆਉਂਦੇ ਰਹਿੰਦੇ ਆ ਲਾਈਫ 'ਚ ਉੱਦਾਂ ਅਪਣਾਉਣਾ ਚਾਹੀਦਾ ਆਪਣੀ ਲਾਈਫ ਨੂੰ ਉਚਾਈਆਂ ਸਾਨੂੰ ਕੁਛ ਨਹੀਂ ਕਹਿੰਦੀਆਂ ਬਸ ਸਾਨੂੰ ਪ੍ਰੀਕੋਸ਼ਨਸ ਲੈਣੀਆਂ ਚਾਹੀਦੀਆਂ ਕਿ ਅਸੀਂ ਬਨੇਰੇ ਤੋਂ ਡਿੱਗ ਨਾ ਜਾਈਏ ਫਿਰ ਇੱਕ ਵਾਰ ਦੀ ਗੱਲ ਹੈ ਮੈਂ ਵੰਡਰਲੈਂਡ ਗਿਆ ਸੀ ਉੱਥੇ ਮੈਂ ਵੀਲ ਝੂਲੇ ਉੱਤੇ ਬੈਠਾ ਜਦੋਂ ਚੱਲਿਆ ਅਤੇ ਜਦੋਂ ਝੂਲਾ ਸਭ ਤੋਂ ਉੱਪਰ ਪੁੱਜਿਆ ਤਾਂ ਥੱਲੇ ਵੇਖ ਕੇ ਮੈਨੂੰ ਡਰ ਲੱਗਣਾ ਸ਼ੁਰੂ ਹੋ ਗਿਆ ਅਤੇ ਮੈਂ ਬੜਾ ਨਰਵਸ ਹੋ ਗਿਆ ਸੀ ਮੈਂ ਬੇਹੋਸ਼ ਵੀ ਹੋ ਗਿਆ ਸੀ ਇਸ ਕਰਕੇ ਮੈਨੂੰ ਹਾਂ ਅੱਜ ਤੱਕ ਉਚਾਈਆਂ ਤੋਂ ਡਰ ਲੱਗਦਾ ਹੈ ਇਹ ਘਟਨਾ ਕਦੇ ਭੁੱਲਦੀ ਨਹੀਂ ਮੈਨੂੰ